ਡੇਂਗੂ ਬੁਖਾਰ ਅਤੇ ਮਲੇਰੀਆ ਦਾ ਮੱਛਰ ਸਭ ਤੋਂ ਵੱਧ ਬਰਸਾਤੀ ਮੌਸਮ ਵਿੱਚ ਪੈਦਾ ਹੁੰਦਾ ਹੈ ਇਸ ਦਾ ਕਾਰਨ ਇਹ ਹੈ ਕਿ ਬਰਸਾਤੀ ਮੌਸਮ ਵਿੱਚ ਪਾਣੀ ਖੜ ਜਾਂਦਾ ਹੈ ਅਤੇ ਗੰਦਗੀ ਵੱਧ ਜਾਂਦੀ ਹੈ ਖੜੇ ਪਾਣੀ ਵਿੱਚ ਇਹ ਮੱਛਰ ਸਭ ਤੋਂ ਛੇਤੀ ਪੈਦਾ ਹੁੰਦਾ ਹੈ ਡੇਂਗੂ ਅਤੇ ਮਲੇਰੀਆ ਦੇ ਮੱਛਰ ਤੋਂ ਬਚਣਾ ਜ਼ਰੂਰੀ ਇਸ ਲਈ ਹੈ ਕਿਉਂਕਿ ਡੇਂਗੂ ਅਤੇ ਬੁਖਾਰ ਦੇ ਮੱਛਰ ਇਨਸਾਨ ਨੂੰ ਅੰਦਰੋਂ ਕਮਜ਼ੋਰ ਬਣਾ ਦਿੰਦੇ ਹਨ ਇਹਨਾਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਇਨਸਾਨ ਲਈ ਬਹੁਤ ਹੀ ਹਾਨੀਕਾਰਕ ਵੀ ਸਾਬਿਤ ਹੋ ਸਕਦੀਆਂ ਹਨ ਇਸ ਲਈ ਸਾਨੂੰ ਬਰਸਾਤੀ ਮੌਸਮ ਦੀ ਸ਼ੁਰੂਆਤ ਵਿੱਚ ਹੀ ਆਪਣੇ ਘਰਾਂ ਵਿੱਚ ਸਪਰੇ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਮੱਛ ਮੱਛਰਾਂ ਤੋਂ ਸ਼ੁਰੂਆਤ ਵਿੱਚ ਹੀ ਬਚਿਆ ਜਾ ਸਕੇ ਸਾਨੂੰ ਰਾਤ ਨੂੰ ਮੱਛਰਦਾਨੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਬਜ਼ੁਰਗਾਂ ਅਤੇ ਬੱਚਿਆਂ ਨੂੰ ਪੂਰੀਆਂ ਬਾਹਵਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ ਕੂਲਰ ਦਾ ਪਾਣੀ ਸਾਫ ਰੱਖਣਾ ਚਾਹੀਦਾ ਹੈ ਕਿਉਂਕਿ ਬਰਸਾਤੀ ਮੌਸਮ ਵਿੱਚ ਕੂਲਰ ਦੀ ਵਰਤੋਂ ਘੱਟ ਜਾਂਦੀ ਹੈ ਜਿਸ ਕਰਕੇ ਉਸ ਦਾ ਪਾਣੀ ਖੜਾ ਰਹਿੰਦਾ ਹੈ ਇਸ ਪਾਣੀ ਵਿੱਚ ਮੱਛਰ ਪੈਦਾ ਹੁੰਦਾ ਹੈ ਅਤੇ ਇਹ ਸਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਸ ਲਈ ਸਾਨੂੰ ਕੂਲਰ ਦਾ ਪਾਣੀ ਸਾਫ ਰੱਖਣਾ ਚਾਹੀਦਾ ਹੈ ਸਾਨੂੰ ਸ਼ਾਮ ਦੇ ਵੇਲੇ ਬਾਹਰ ਘੱਟ ਨਿਕਲਣਾ ਚਾਹੀਦਾ ਹੈ ਕਿਉਂਕਿ ਸ਼ਾਮ ਅਤੇ ਰਾਤ ਨੂੰ ਹੀ ਮੱਛਰ ਸਭ ਤੋਂ ਜ਼ਿਆਦਾ ਹੁੰਦਾ ਹੈ ਬੱਚਿਆਂ ਨੂੰ ਘਾਹ ਵਿੱਚ ਨਹੀਂ ਖੇਡਣਾ ਚਾਹੀਦਾ ਕਿਉਂਕਿ ਮੱਛਰ ਇਸ ਘਾਹ ਵਿੱਚ ਲੁਕਿਆ ਹੁੰਦਾ ਹੈ ਸਾਨੂੰ ਆਪਣੇ ਆਲੇ ਦੁਆਲੇ ਸਾਫ ਸਫਾਈ ਰੱਖਣੀ ਚਾਹੀਦੀ ਹੈ ਅਤੇ ਸਾਡੇ ਘਰ ਦੇ ਨੇੜੇ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤੇ ਵੀ ਪਾਣੀ ਖੜਿਆ ਨਾ ਹੋਵੇ ਅਤੇ ਬੱਚਿਆਂ ਨੂੰ ਇਸ ਕਿਤੇ ਵੀ ਇਸ ਜਗ੍ਹਾ 'ਤੇ ਨਹੀਂ ਜਾਣਾ ਚਾਹੀਦਾ ਜਿੱਥੇ ਪਾਣੀ ਖੜਾ ਹੋਵੇ ਜਾਂ ਫਿਰ ਗੰਦਗੀ ਜ਼ਿਆਦਾ ਹੋਵੇ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਮੱਛਰ ਸਾਨੂੰ ਬਹੁਤ ਹੀ ਵੱਡੀ ਬਿਮਾਰੀ ਕਰਵਾ ਸਕਦੇ ਹਨ